ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਗੁਰਜਬੀਰ ਬਰਾੜ ਬੋਲਦਾਂ ਲੁਧਿਆਣਾ ਤੋਂ ਇਥੇ ਸਾਡੇ ਮੁੰਡੇ ਦੀ ਪਹਿਲੀ ਲੋਹੜੀ ਸੈਲੀਬਰੇਟ ਕਰਨੀ ਸੀ ਆਪਾਂ ਅਤੇ ਜਿਸ ਕਰਕੇ ਸਾਨੂੰ ਉਹ ਭੁਗਾ ਉਹ ਚਾਹੀਦੀ ਖਜੂਰਾਂ ਅਤੇ ਮੈਨੂੰ ਸੁਣਨ 'ਚ ਆਇਆ ਮੇਰੇ ਕੋਈ ਰਿਸ਼ਤੇਦਾਰ ਸੀਗੇ ਅਤੇ ਮੇਰੇ ਕੁਝ ਦੋਸਤ ਸੀਗੇ ਜਿਨ੍ਹਾਂ ਤੁਹਾਡੇ ਕੋਲ ਪਹਿਲਾਂ ਹੀ ਮੰਗਵਾਈਆਂ ਹੋਈਆਂ ਹੈਗੀਆਂ ਖਜੂਰਾਂ ਅਤੇ ਭੁੱਗਾ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕੋਲ ਸਭ ਤੋਂ ਅੰਬਰ ਅੰਮ੍ਰਿਤਸਰ ਦੀ ਸਭ ਤੋਂ ਵਧੀਆ ਹੁੰਦੀਆਂ ਖਜੂਰਾਂ ਅਤੇ ਭੋਗਾ ਕੀ ਮੈਂ ਜਾਣ ਸਕਦਾ ਕਿ ਤੁਹਾਡੇ ਹੈਗੀ ਆ ਉਹ ਜੀ ਮੈਡਮ ਮੈਨੂੰ ਲੋਹੜੀ ਵਾਲੇ ਦਿਨ ਚਾਹੀਦੀ ਕਿ ਮੇਰੇ ਮੁੰਡੇ 'ਚ ਪਹਿਲੀ ਲੋਹੜੀ ਹੈਗੀ ਹੈ ਜਿਹਦੇ ਕਰਕੇ ਆਪਾਂ ਸੈਲੀਬਰੇਟ ਕਰਨ ਲਈ ਲੋਹੜੀ ਮਨਾਉਣੀ ਅਸੀਂ ਸਾਰੇ ਰਿਸ਼ਤੇਦਾਰ ਬਹੁਤ ਇਕੱਠੇ ਹੋਏ ਹੈਗੇ ਜਿਹਦੇ ਕਰਕੇ ਤੁਸੀਂ ਲਾ ਲਓ ਮੈਨੂੰ ਘੱਟੋ ਘੱਟ ਪੰਜਾਹ ਕਿਲੋ ਭੁੱਗਾ ਅਤੇ ਪੰਜਾਹ ਕਿਲੋ ਖਜੂਰਾਂ ਚਾਹੀਦੀਆਂ ਹੀ ਚਾਹੀਦੀਆਂ ਹੈਗੀਆਂ ਬਈ ਤੁਸੀਂ ਮੇਰਾ ਔਡਰ ਕਰ ਸਕਦੇ ਹੈਗੇ ਹੋ ਅਤੇ ਮੈਨੂੰ ਦੱਸ ਦਿਓ ਕਿੰਨੇ ਪੈਸੇ ਹੈਗੇ ਪੈਸੇ ਵੀ ਕੋਈ ਟੈਂਸ਼ਨ ਨਹੀਂ

ਮੈਮ ਜੇ ਕੋਈ ਸਾਡਾ ਸਾਰੇ ਰਿਸ਼ਤੇਦਾਰ ਆਏ ਹੋਏ ਹੈਗੇ ਆ ਸਾਡਾ ਆਉਣਾ ਔਖਾ ਹੈਗਾ ਤੁਸੀਂ ਲੁਧਿਆਣੇ ਤੋਂ ਹੈਗੇ ਅੰਮ੍ਰਿਤਸਰ ਆਉਣਾ ਪੈਣਾ ਥੋੜ੍ਹਾ ਔਖਾ ਕੰਮ ਹੈਗਾ ਕਿ ਤੁਸੀਂ ਪਰਿਵਾਰ ਸਾਨੂੰ ਭੇਜ ਸਕਦੇ ਹੋ ਕਿਸੇ ਬੰਦੇ ਹੱਥ ਅਸੀਂ ਤੁਹਾਨੂੰ ਪੈਸੇ ਦੇ ਦੇਵਾਂਗੇ ਜਿੰਨੇ ਪੈਸੇ ਉਹ ਡਿਲੀਵਰੀ 'ਚ ਬੰਦੇ ਹੋਏਗੀ ਜਾਂ ਮੁੰਡੇ ਦੀ ਦਿਹਾੜੀ ਜਿੰਨੀ ਵੀ ਹੋਏਗੀ ਅਸੀਂ ਤੁਹਾਨੂੰ ਦੇ ਦੇਵਾਂਗੇ ਕੀ ਭੇਜ ਸਕਦੇ ਹੈਗੇ ਕਿਉਂਕਿ ਸਾਡੇ ਮੁੰਡੇ ਪਹਿਲੀ ਲੋੜੀ ਹੈ ਤੁਹਾਨੂੰ ਪਤਾ ਹੀ ਜਿੱਦਾਂ ਅਤੇ ਅਸੀਂ ਇੱਦਾਂ ਨਹੀਂ ਚਾਹੁੰਦੇ ਕਿ ਸਾਡੇ ਮੁੰਡੇ ਦੀ ਪਹਿਲੀ ਲੋਹੜੀ ਹੈਗੀ ਜੋ ਖ਼ਰਾਬ ਹੋ ਜਾਵੇ ਕਿ ਉਥੇ ਲੋੜੀ ਜਿਹੜੀ ਖ਼ਾਸੀਅਤ ਹੈਗੀ ਹੈ ਭੂਗਾ ਅਤੇ ਉਹ ਖਜੂਰਾਂ ਓਹੀ ਨਾ ਹੋਵੇ ਇੱਦਾਂ ਹੋ ਨਹੀਂ ਸਕਦਾ ਫਿਰ ਸਾਡੇ ਮੁੰਡੇ ਪਹਿਲੀ ਲੋੜ ਹੀ ਹੈਗੀ ਹੈ ਦੇਖ ਲਓ ਥੋੜ੍ਹਾ ਜਿਹਾ ਅਤੇ ਮੈਂ ਮੋਟਾ ਮੋਟੇ ਤੁਹਾਡੇ ਸਾਹਮਣੇ ਕਿੰਨਾ ਕੁ ਹੋ ਜਾਏਗਾ ਉਸ ਹਿਸਾਬ ਨਾਲ ਦੱਸ ਦਿਓ ਮੈਂ ਤੁਹਾਨੂੰ ਐਡਵਾਂਸ ਭੇਜ ਦੇਵਾਂਗਾ ਫਿਰ ਮੈਨੂੰ ਇੱਕ ਹੋਰ ਗੱਲ ਕਿ ਮੈਨੂੰ ਸਾਫ਼ ਸੁਥਰਾ ਕੰਮ ਤੁਹਾਨੂੰ ਪਤਾ ਹੁੰਦਾ ਸਾਫ਼ ਸੁਥਰਾ ਕੰਮ ਹੈਗਾ ਪਰ ਮੈਨੂੰ ਟਾਈਮ 'ਤੇ ਚਾਹੀਦੀ ਹੈਗੀ ਚੀਜ਼ਾਂ ਕਿ ਜਿਦਾਂ ਦੁਪਹਿਰ ਤੱਕ ਪਹੁੰਚ ਜਾਵੇ ਠੀਕ ਹੈ ਮੈਡਮ ਅਤੇ ਡਿਲੀਵਰੀ ਕਿੰਨੀ ਹੋਈ ਠੀਕ ਹੈ ਮੈਡਮ ਅਤੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਮੁੰਡੇ ਦਿਹਾੜੀ ਦਿਹੁੜੀ ਸਭ ਵਿੱਚੇ ਪੰਜ ਹਜ਼ਾਰ ਦੇ ਤੁਹਾਨੂੰ ਅਲੱਗ ਤੋਂ ਦੇਣੀ ਪੈਣੀ ਹੈਗੀ ਹੈ ਓਕੇ ਮੈਮ ਤੁਹਾਨੂੰ ਐਡਵਾਂਸ ਕੀਤਾ ਕਰਾਂ ਮੈਂ ਆਨਲਾਈਨ ਭੇਜਦਾ ਕਿਦਾ ਕਰਾਂ ਗੂਗਲ ਪੇ ਫੋਨਪੇ ਤੁਸੀਂ ਮੈਨੂੰ ਸਕੈਨਰ ਵਗੈਰਾ ਭੇਜ ਦਿਓ ਮੈਂ ਪਾ ਦਿਆਂਗਾ ਤੁਹਾਨੂੰ ਹੁਣੇ ਹੀ ਅਤੇ ਮੈਡਮ ਹੁਣੇ ਪਾ ਦਿੰਦਾ ਤੁਸੀਂ ਭਾਵੇਂ ਕੋਲ 'ਤੇ ਹੀ ਲੈ ਲਓ ਮੈਂ ਹੁਣ ਪਾ ਦਿੰਦਾ ਹੈਗਾ ਅਤੇ ਮੈਮ ਬਿਲ ਵਗੈਰਾ ਨਾਲ ਹੀ ਭੇਜੋਗੇ ਤੁਸੀਂ ਉਹਦੇ ਠੀਕ ਹੈ ਮੈਡਮ ਓਕੇ ਮੈਮ ਅਤੇ ਮੈਨੂੰ ਭੇਜ ਦੇਣਾ ਯਾਦ ਨਾਲ ਟਾਈਮ ਸਿਰ ਬਸ ਇੰਨਾ ਹੀ ਕਹਿਣਾ ਚੰਗਾ ਜੀ ਸਤਿ ਸ਼੍ਰੀ ਅਕਾਲ